ਹਾਂ ਮੈਨੇ ਬਹੁਤ ਸਾਰੀਆਂ ਅਕਾਸ਼ੀ ਘਟਨਾਵਾਂ ਦੇਖੀਆਂ ਨੇ ਹਾਂ ਮੈਨੂੰ ਇਹ ਦੇਖਣੀਆਂ ਬਹੁਤ ਪਸੰਦ ਨੇ ਅਕਾਸ਼ੀ ਘਟਨਾਵਾਂ ਜਿਵੇਂ ਕਿ ਸੂਰਜ ਗ੍ਰਹਿਣ ਹੋ ਗਿਆ ਚੰਦਰਮਾ ਗ੍ਰਹਿਣ ਹੋ ਗਿਆ ਜਿਵੇਂ ਟੁੱਟਦਾ ਤਾਰਾ ਹੋ ਗਿਆ ਅਤੇ ਕੋਈ ਵੀ ਧੂਮ ਕੇਤੁ ਹੋ ਗਿਆ ਵਿਅਕਤੀਗਤ ਤੌਰ 'ਤੇ ਹਾਂ ਮੈਨੇ ਬਹੁਤ ਵਾਰੀ ਦੇਖੀਆਂ ਨੇ ਇਹ ਜਿਵੇਂ ਕਿ ਇੱਕ ਵਾਰੀ ਦੋ ਹਜ਼ਾਰ ਵੀਹ ਦੀ ਗੱਲ ਹੈ ਜਦੋਂ ਅਸੀਂ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਅਸੀਂ ਦਿਨ ਵਿੱਚ ਸੂਰਜ ਗ੍ਰਹਿਣ ਦੇਖਣ ਦੀ ਕੋਸ਼ਿਸ਼ ਕੀਤੀ ਇਹ ਸੂਰਜ ਗ੍ਰਹਿਣ ਦੇਖਣ ਲਈ ਅਸੀਂ ਇੱਕ ਪਾਣੀ ਦੀ ਥਾਲ ਵਿੱਚ ਲਿਆ ਥਾਲ ਵਿੱਚ ਪਾਣੀ ਪਾ ਕੇ ਉਸ ਵਿੱਚ ਸੂਰਜ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਨਾਲ ਅਸੀਂ ਦੇਖਿਆ ਕਿ ਸੂਰਜ ਹੌਲੀ ਹੌਲੀ ਸੂਰਜ ਅੱਗੇ ਇੱਕ ਕਾਲਾ ਪਰਦਾ ਜਿਹਾ ਛਾ ਰਿਹਾ ਸੀ ਜਿਸ ਨਾਲ ਸੂਰਜ ਪੂਰੀ ਤਰ੍ਹਾਂ ਢਕ ਗਿਆ ਢਕਿਆ ਜਾਣ ਨਾਲ ਸੂਰਜ ਕਾਲਾ ਹੋ ਗਿਆ ਜਮਾਂ ਅਤੇ ਇਸਨੂੰ ਅਸੀਂ ਐਨਕ ਦੇ ਵਿੱਚ ਐਨਕ ਦੇ ਨਾਲ ਵੀ ਦੇਖਿਆ ਅਤੇ ਇਸ ਨੂੰ ਆਪਣਾ ਐਕਸਰੇ ਜਿਹੜੀ ਸੀਟ ਹੁੰਦੀ ਆ ਉਹ 'ਤੇ ਉਸਦੇ ਜ਼ਰੀਏ ਵੀ ਦੇਖਿਆ ਇਸ ਤੋਂ ਇਲਾਵਾ ਸੂਰਜ ਗ੍ਰਹਿਣ ਚੰਦਰਮਾ ਗ੍ਰਹਿਣ ਰੋਜਾਨੇ ਆਪਣੇ ਸਾਲ ਵਿੱਚ ਤਿੰਨ ਚਾਰ ਵਾਰੀ ਦੇਖਣ ਨੂੰ ਮਿਲ ਜਾਂਦੇ ਨੇ ਅਤੇ ਇਸ ਤੋਂ ਬਾਅਦ ਧੂਮ ਕੇਤੂ ਧੂਮ ਕੇਤੂ ਜਿਹੜੇ ਹੁੰਦੇ ਨੇ ਇਹ ਇਹ ਇੱਕ ਤਰ੍ਹਾਂ ਦੇ ਟੁੱਟਦੇ ਉਲਕਾ ਪਿੰਡ ਲਗਾ ਲਓ ਜਾਂ ਟੁੱਟਦਾ ਤਾਰਾ ਲਗਾ ਲਓ ਉਸ ਨੂੰ ਕਿਹਾ ਜਾਂਦਾ ਇਹ ਹਮੇਸ਼ਾ ਅਸੀਂ ਹਮੇਸ਼ਾ ਰਾਤ ਨੂੰ ਹੀ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਟੁੱਟਦਾ ਤਾਰਾ ਉਸ ਵੇਲੇ ਦੇਖਣ ਨੂੰ ਮਿਲਦਾ ਇਹ ਜ਼ਿਆਦਾਤਰ ਰਾਤ ਦੇ ਤਿੰਨ ਜਾਂ ਚਾਰ ਵਜੇ ਦੇਖਣ ਨੂੰ ਮਿਲਦੇ ਨੇ ਹਾਂ ਮੈਨੂੰ ਦੇਖਣਾ ਬਹੁਤ ਪਸੰਦ ਹੈ ਧੰਨਵਾਦ